ਮੈਨੂੁੰ ਇੱਕ ਬੜੀ ਰੌਚਕ ਕਿਤਾਬ ਲੱਗੀ ਜਿਹਦੀ ਕਿ ਮੈਨੂੰ ਮਨ ਨੂੰ ਮੋਹਣ ਵਾਲ਼ੀ ਅਤੇ ਲੋਕਾਂ ਨੂੰ ਸਿੱਖਿਆ ਦੇਣ ਵਾਲੀਆਂ ਸਿੱਖਿਆ ਦੇਣ ਵਾਲ਼ੀ ਅਤੇ ਜਿਵੇਂ ਕਿ ਰੁੱਖਾਂ ਦੇ ਗੀਤ ਰੁੱਖਾਂ ਦੇ ਗੀਤਾਂ ਦੇ ਵਿੱਚ ਇਹ ਦਿੱਤਾ ਗਿਆ ਹਰੇਕ ਜਿਹੜਾ ਵੀ ਪੇੜ ਹੈ ਦਰੱਖਤ ਆ ਜਿਵੇਂ ਕਿ ਕਿੱਕਰ ਹੋ ਗਈ ਕਿੱਕਰ ਦੇ ਗੀਤ ਤੁੱਕਿਆਂ ਦੇ ਉੱਤੋਂ ਲੈ ਕੇ ਜੜ੍ਹ ਤੱਕ ਇਹਦੇ ਸਾਰੇ ਹੀ ਲਾਭਦਾਇਕ ਲਾਭਦਾਇਕਾ ਅਤੇ ਗੁਣਕਾਰੀ ਨੇ ਇਹਦੀ ਲੱਕੜ ਤੱਕ ਵੀ ਕੰਮ ਆਉਂਦੀ ਹੈ ਫੇਰ ਉਸ ਤੋਂ ਬਾਅਦ ਟਾਹਲੀ ਆ ਗਈ ਟਾਹਲੀ ਦੀ ਵੀ ਦਾਤਣ ਤੋਂ ਲੈ ਕੇ ਜੜ੍ਹ ਤੋਂ ਲੈ ਕੇ ਦਾਤਣ ਤੱਕ ਟਾਹਣੀਆਂ ਤੱਕ ਉਹ ਹਰ ਜਗ੍ਹਾ 'ਤੇ ਵਰਤੋਂ ਕੀਤੀ ਜਾਂਦੀ ਹੈ ਇਹਦੇ ਵਿੱਚ ਦਰਵਾਜ਼ੇ ਖਿੜਕੀਆਂ ਅਤੇ ਨਾਲ਼ ਸਾਨੂੰ ਆਕਸੀਜਨ ਵੀ ਵਾਧੂ ਦਿੰਦੇ ਨੇ ਆਕਸੀਜਨ ਹੈ ਪੌਦੇ ਹੈਗੇ ਤਾਂ ਆਕਸੀਜਨ ਜੇ ਆ ਪੌਦੇ ਨਹੀਂ ਹੈਗੇ ਤਾਂ ਆਕਸੀਜਨ ਖਤਮ ਆ ਅਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਜ਼ਿਆਦਾ ਹੋਜੂਗੀ ਇਸ ਕਰਕੇ ਇਹ ਕਿਤਾਬ ਮੈਨੂੰ ਬੜੀ ਹੀ ਚੁਣੌਤ ਸੋਹਣੀ ਚੁਣੌਤੀ ਭਰੀ ਅਤੇ ਚੁਣੌਤੀਪੂਰਨ ਬਣਾਉਣ ਵਾਸਤੇ ਮੈਨੂੰ ਇਹ ਕਿਤਾਬ ਦਾ ਬੜਾ ਦਿਲਚਸਪ ਮੈਂ ਲੋਕਾਂ ਦੇ ਵਿੱਚ ਵੀ ਪਰਿਵਾਰਾਂ ਦੇ ਵਿੱਚ ਵੀ ਦੋਸਤਾਂ ਦੇ ਵਿੱਚ ਵੀ ਇਹਦੀ ਬਹੁਤ ਜ਼ਿਆਦਾ ਚਰਚਾ ਕਰਦਾ ਵੀ ਕਿਤਾਬ ਰੁੱਖਾਂ ਦੇ ਗੀਤ